ਅੱਜ ਕੱਲ੍ਹ ਦੇ ਵਿਗਿਆਨਿਕ ਜ਼ਮਾਨੇ ਵਿੱਚ ਵੀ ਲੋਕ ਅਜੇ ਵੀ ਵਹਿਮਾਂ ਭਰਮਾਂ 'ਤੇ ਵਿਸ਼ਵਾਸ ਕਰਨਾ ਨਹੀਂ ਛੱਡਦੇ ਜਿੱਦਾਂ ਕਿ ਅਸੀਂ ਕਿਸੀ ਕਿਤੇ ਜਾ ਰਹੇ ਹੋਈਏ ਅਤੇ ਕੋਈ ਬਿੱਲੀ ਆ ਕੇ ਸਾਡਾ ਰਸਤਾ ਕੱਟ ਜਾਵੇ ਤਾਂ ਲੋਕ ਉਸ ਰਸਤਿਓਂ ਨਹੀਂ ਜਾਂਦੇ ਕਿਉਂਕਿ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਮੇਰੇ ਘਰ ਵਿੱਚ ਵੀ ਇਹੋ ਜਿਹੇ ਵਹਿਮ ਭਰਮ ਬਹੁਤ ਮੰਨੇ ਜਾਂਦੇ ਹਨ ਜਿੱਦਾਂ ਕਿ ਘਰੋਂ ਜਾਣ ਤੋਂ ਪਹਿਲਾਂ ਜੇ ਕੋਈ ਪਿੱਛੋਂ ਟੋਕ ਦੇਵੇ ਜਾਂ ਛਿੱਕ ਮਾਰ ਦਵੇ ਤਾਂ ਉਹ ਉਦੋਂ ਘਰੋਂ ਨਹੀਂ ਨਿਕਲਿਆ ਜਾਂਦਾ ਅਤੇ ਕੁਛ ਦੇਰ ਅ ਰੁਕ ਕੇ ਫਿਰ ਨਿਕਲਦੇ ਹਨ ਕਿਤੇ ਵੀ ਜਾਣਾ ਹੋਵੇ ਤਾਂ ਤਿੰਨ ਲੋਕ ਇਕੱਠੇ ਘਰੋਂ ਨਹੀਂ ਨਿਕਲਦੇ ਬੁੱਧਵਾਰ ਨੂੰ ਪੇਕਿਓਂ ਵਾਪਸ ਨਹੀਂ ਆਉਂਦੀਆਂ ਧੀ ਧੀਆਂ ਸ਼ਾਮ ਦੇ ਵੇਲੇ ਝਾੜੂ ਮਾਰਨਾ ਅਸ਼ੁੱਭ ਮੰਨਿਆ ਜਾਂਦਾ ਹੈ ਵੀਰਵਾਰ ਨੂੰ ਵਾਲ ਨਹੀਂ ਕਟਵਾਉਣ ਦਿੰਦੇ ਮੈਨੂੰ ਅਤੇ ਖਿ ਕਿਤੇ ਵੀ ਕੋਈ ਸ਼ੁੱਭ ਕੰਮ ਕਰਨ ਜਾਣਾ ਹੋਵੇ ਜਾਂ ਕੋਈ ਮੈਨੂੰ ਮੇਰਾ ਇਮਤਿਹਾਨ ਹੋਵੇ ਤਾਂ ਮੈਨੂੰ ਦੁੱਧ 'ਚ ਦਹੀਂ ਵਿੱਚ ਚੀਨੀ ਮਿਲਾ ਕੇ ਖਵਾ ਕੇ ਭੇਜਿਆ ਜਾਂਦਾ ਹੈ